ਹਾ ਖਾਣਾ ਬਣਾਉਂਣਾ ਸਿਰਫ਼ ਔਰਤਾਂ ਦਾ ਕੰਮ ਹੈ ਔਰਤਾਂ ਖਾਣਾ ਬਣਾਉਂਦੀਆਂ ਹਨ ਰਸੋਈ ਸਾਂਭਣਾ ਔਰਤਾਂ ਦਾ ਕੰਮ ਹੀ ਹੁੰਦਾ ਹੈ ਪਰ ਜੇਕਰ ਪਤੀ ਪਤਨੀ ਦੋਨੋਂ ਹੀ ਕਿਸੇ ਸਰ ਜੋ ਕੋਈ ਵੀ ਜੋਬ ਕਰਦੇ ਹਾਂ ਤਾਂ ਕੋਈ ਮਰਦ ਨੂੰ ਖਾਣਾ ਖਾਣਾ ਚਾਹੀਦਾ ਹੈ ਆਪਣੀ ਪਤਨੀ ਨਾਲ ਮਦਦ ਕਰਵਾਉਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਇਹ ਇਹ ਕੰਮ ਔਰਤ ਦਾ ਹੈ ਹਮੇਸ਼ਾ ਔਰਤ ਹੀ ਕਰੇ ਨਹੀਂ ਇਹ ਗਲਤ ਹੈ ਔਰਤ ਨੂੰ ਨਹੀਂ ਔਰ ਤ ਨੂੰ ਆਪਣੇ ਹਸਬੈਂਡ ਨਾ ਨਾਲ ਮਦਦ ਕਰਦੇ ਨੌਕਰੀ ਕਰਦੇ ਹਾਂ ਤਾਂ ਮਮ ਇੱਕ ਔਰਤ ਆਪਣੀ ਹਸਬੈਂਡ ਦੀ ਮਦਦ ਕਰਾ ਰਹੀ ਹੈ ਤਾਂ ਇਸ ਵਿੱਚ ਅਪ ਇੱਕ ਮਰਦ ਨੂੰ ਵੀ ਆਪਣੀ ਪਤਨੀ ਨਾਲ ਰਸੋਈ ਦੇ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ ਹੈਗਾ ਖਾਣਾ ਬਣਾਉਣਾ ਚਾਹੀਦਾ ਜ਼ਰੂਰੀ ਨਹੀਂ ਖਾਣਾ ਹੀ ਬਣਾਉਣਾ ਜਿਵੇਂ ਉਹਨਾਂ ਦੀ ਹੈਲਪ ਮਦਦ ਕੀਤੀ ਕੋਈ ਸਬਜ਼ੀ ਕਟਿੰਗ ਕਰਤੀ ਕੋਲ ਕੋਈ ਕਿਚਨ ਦਾ ਸਮਾਨ ਸਾਰਾ ਪ੍ਰੋਪਰ ਕੋਲ ਰੱਖ ਦਿੱਤਾ ਅਤੇ ਜਿਵੇਂ ਚਾਹ ਬਣਾ ਲਈ ਇਹ ਮਰਦ ਕਰ ਸਕਦਾ ਜ਼ਰੂਰੀ ਨਹੀਂ ਇੱਕ ਔਰਤ ਹੀ ਕਰੂਗੀ ਔਰਤ ਕਿਚਨ ਰਸੋਈ ਸਾਂਭਦੀ ਹੈ ਪਰ ਸ ਔਰਤ ਦਾ ਕੰਮ ਹੈ ਪਰ ਮਰਦ ਨੂੰ ਵੀ ਨਾਲ ਔਰਤ ਦੇ ਕੰਮ ਕਰਵਾਉਣਾ ਚਾਹੀਦਾ